ਸਤਿ ਸ਼੍ਰੀ ਅਕਾਲ ਮੇਰਾ ਨਾਂ ਅਰਮਾਨਦੀਪ ਸਿੰਘ ਹੈ ਮੈਂ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੇਰੀ ਮਨਪੰਸਾਈਦ ਡਰਾਇੰਗ ਹੈ ਮੈਨੂੰ ਡਰਾਇੰਗ ਕਰਕੇ ਮੈਨੂੰ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਹੈ ਮੈਨੂੰ ਡਰਾਇੰਗ ਵਿੱਚ ਪੇਂਟ ਬਰਸ਼ ਡੋਮਸ ਕੰਪਨੀ ਦੇ ਬਹੁਤ ਵਧੀਆ ਲੱਗਦੇ ਹਨ ਇਹ ਬਹੁਤ ਡੋਮਸ ਕੰ ਕੰਪਨੀ ਦੇ ਕਲਰ ਬਹੁਤ ਹੀ ਸਫਾਈ ਦੇਣ ਨਾਲ ਵਰਤੇ ਜਾਂਦੇ ਹਨ ਇਹਨਾਂ ਦਾ ਵਰਤਣ ਨਾਲ ਮੈਨੂੰ ਬਹੁਤ ਹੀ ਨਾਲ ਇਹਨਾਂ ਦੇ ਹੱਥਾਂ ਨਾਲ ਹੱਥਾਂ ਨੂੰ ਵੀ ਕੁਛ ਨਹੀਂ ਹੁੰਦਾ ਬਾਕੀ ਕਲਰ ਕਈ ਹੱਥ ਨਾਲ ਲੱਗ ਜਾਂਦੇ ਹਨ ਅਤੇ ਹੱਥ ਖ਼ਰਾਬ ਕਰ ਦਿੰਦੇ ਹਨ ਇਹਨਾਂ ਦੀ ਗਰੰਟੀ ਵੀ ਹੁੰਦੀ ਹੈ ਕਿ ਇਹ ਹੱਥਾਂ ਨੂੰ ਕੁਛ ਵੀ ਨਹੀਂ ਹੁੰਦਾ ਇਹਨਾਂ ਨਾਲ ਡਰਾਇੰਗ ਵੀ ਵਧੀਆ ਹੁੰਦੀ ਹੈ ਅਤੇ ਮੈਂ ਦੋ ਤਿੰਨ ਵਾਰੀ ਡਰਾਇੰਗ ਭਾਗ ਵਿੱਚ ਡੋਮਸ ਕਲਰ ਦੀ ਕੰਪਨੀ ਨਾਲ ਮਿਲ ਗਿਆ ਮੈਂ ਇਹ ਪਹਿਲੇ ਅੰਕ 'ਤੇ ਆਇਆ ਹਾਂ ਡੋਮਸ ਕਲਰ ਬਹੁਤ ਹੀ ਵਧੀਆ ਹਨ ਪੇਂਟ ਮੈਨੂੰ ਕਈ ਵਾਰ ਮੈਂ ਡੋਮ ਕਈ ਕੰਪਨੀਆਂ ਦੇ ਪੇਂਟ ਬਰਸ਼ ਯੂਸ ਕਰਦਾ ਹਾਂ ਡਰਾਇੰਗ ਕਰਨ ਸਮੇਂ ਆ ਤਾਂ ਮੇਰੀ ਡਰਾਇੰਗ ਬਹੁਤ ਹੀ ਬੇਕਾਰ ਹੋਈ ਜਾਂਦੀ ਹੈ ਤਾਂ ਕਰਕੇ ਹੁਣ ਮੈਂ ਡੋਮਸ ਕੰਪਨੀ ਦੇ ਹੀ ਇਕੱਲੇ ਮੈਂ ਪੇਂਟ ਬਰਸ਼ ਕਰਨਾ ਜੂ ਯੂਸ ਕਰਨਾ ਸ਼ੁਰੂ ਕਰ ਦਿੱਤਾ ਹੈ ਇਹ ਇਕ ਇਹ ਯੂਸ ਕਰਨ ਨਾਲ ਮੈਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਮੇਰੇ ਹੱਥ ਵੀ ਵਧੀਆ ਸੋਫਟ ਅਤੇ ਬਹੁਤ ਵਧੀਆ ਲੱਗਦੇ ਹੱਥਾਂ ਨੂੰ ਵੀ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈ ਬਾਕੀ ਕਲਰਾਂ ਦਾ ਪੇਂਟ ਦਾ ਬਰਸ਼ਾ ਦਾ ਬਹੁਤ ਨੁਕਸਾਨ ਹੈ ਇਹ ਸਾਡੀ ਸਕਿ ਬਾਕੀ ਹੋਰ ਕਲਰ ਸਾਡੀ ਸਕਿਨ ਦੇ ਰਿਐਕਸ਼ਨ ਕਰ ਜਾਂਦੇ ਹਨ ਪਰ ਇਹਨਾਂ ਦੀ ਗਰੰਟੀ ਹੁੰਦੀ ਹੈ ਕਿ ਇਹ ਕੋਈ ਰਿਐਕਸ਼ਨ ਨਹੀਂ ਕਰਦੇ ਇਹਨਾਂ ਦੇ ਨਾਲ ਸਾਡੇ ਸਕਿਨ ਵੀ ਵਧੀਆ ਰਹਿੰਦੀ ਅਤੇ ਸਾਡੀ ਡਰਾਇੰਗ ਨੂੰ ਹੋਰ ਵੀ ਤਜਰਬੇਦਾਇਕ ਵਧੀਆ ਕਲਰ ਮਿਲ ਜਾਂਦਾ ਹੈ ਇਹ ਕਲਰ ਬਹੁਤ ਵਧੀਆ ਲੱਗਦੇ ਹਨ ਮੈਂ ਤਾਂ ਸਾਰਿਆਂ ਨੂੰ ਇਹੋ ਹੀ ਕਰੂ ਕਹੂੰਗਾ ਕਿ ਡੋਮੇਸ ਕੰਪਨੀ ਦੇ ਕਲਰ ਯੂਸ ਕਰਿਆ ਕਰੋ ਪੇਂਟ ਬਰਸ਼ ਵੀ ਯੂਸ ਕਰਿਆ ਕਰੋ ਬ ਕਿਉਂਕਿ ਇਹ ਬਹੁਤ ਵਧੀਆ ਅਤੇ ਹੋਰ ਵੀ ਬਹੁਤ ਕੈ ਘੈਂਟ ਅਤੇ ਸਹੀ ਹੁੰਦੇ ਹਨ ਇਹ ਯੂਸ ਕਰਨ ਨਾਲ ਸਾਨੂੰ ਬਹੁਤ ਬੜੀਆ ਵਧੀਆ ਲੱਗਦਾ ਹੈ ਸਾਡੀ ਡਰਾਇੰਗ ਮੇਰੇ ਡਰਾਇੰਗ ਟੀਚਰ ਦਾ ਨਾਂ ਦਮਨਪ੍ਰੀਤ ਸਿੰਘ ਹੈ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਡੋਮਸ ਕਲ ਕੰਪਨੀ ਦੇ ਕਲਰ ਬਹੁਤ ਵਧੀਆ ਹਨ ਇਹਨਾਂ ਨੂੰ ਜੂਸ ਕਰਿਆ ਕਰੋ ਤਾਂ ਤੁਹਾਨੂੰ ਬਹੁਤ ਵਧੀਆ ਡਰਾਇੰਗ ਵਿੱਚ ਫਸਟ ਪੁਜ਼ੀਸ਼ਨ ਮਿਲੇਗੀ ਤਾਂ ਮੈਂ ਜਦੋਂ ਦਾ ਡੋਮੈਸ ਕਲਰ ਯੂਜ ਕਰਨੇ ਸ਼ੁਰੂ ਕੀਤੇ ਆ ਤਾਂ ਮੈਂ ਪਹਿਲੇ ਅੰਕ 'ਤੇ ਹੀ ਆਉਂਦਾ ਹਾਂ ਨਹੀਂ ਤਾਂ ਜਦੋਂ ਦੇ ਮੈਂ ਕਿਸੇ ਪਹਿਲਾਂ ਕੋਈ ਹੋਰ ਕੰਪਨੀ ਯੂਸ ਕਰਦਾ ਸੀ ਤਾਂ ਉਹ ਮੇਰੇ ਹੱਥਾਂ ਨਾਲ ਹੱਥਾਂ ਦੇ ਵੀ ਰਿਐਕਸ਼ਨ ਕਰ ਜਾਂਦੇ ਸੀ ਅਤੇ ਮੈਨੂੰ ਕੋਈ ਅੰਕ ਵੀ ਨਹੀਂ ਪ੍ਰਾਪਤ ਹੁੰਦਾ ਸੀ ਇਹ ਯੂਸ ਕਰਨ ਨਾਲ ਮੈਨੂੰ ਪ ਅੰਕ ਵੀ ਬਹੁਤ ਵਧੀਆ ਪ੍ਰਾਪਤ ਹੁੰਦਾ ਹੈ ਅਤੇ ਅੰਕ ਵੀ ਪਹਿਲੇ ਅੰਕ 'ਤੇ ਆਉਂਦਾ ਹਾਂ ਤਾਂ ਮੇਰੇ ਹੱਥਾਂ 'ਤੇ ਉਹ ਸਕਿਨ ਨੂੰ ਕੋਈ ਵੀ ਰਿਐਕਸ਼ਨ ਨਹੀਂ ਹੁੰਦੀ ਹੈ ਇਹ ਮੈਨੂੰ ਬਹੁਤ ਵਧੀਆ ਲੱਗਦੇ ਹਨ